ਸਾਡੇ ਸੱਭਿਆਚਾਰ ਦੇ ਵਿੱਚ ਔਰਤ ਨੂੰ ਇੱਕ ਬੜਾ ਵੱਡਾ ਮਹਾਨ ਦਰਜਾ ਦਿੱਤਾ ਗਿਆ ਹੈ ਸਾਡੇ ਗੁਰੂਆਂ ਪੀਰਾਂ ਨੇ ਵੀ ਆਖਿਆ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਸੋ ਜਿਹੜੀ ਇਹ ਔਰਤ ਦੇ ਵਿੱਚ ਮਹਾਂਮਾਰੀ ਦੀ ਪ੍ਰਕਿਰਿਆ ਹੈ ਇਹ ਇੱਕ ਕੁਦਰਤ ਦੀ ਦਿੱਤੀ ਹੋਈ ਇੱਕ ਦਾਤ ਹੀ ਕਹਿ ਸਕਦੇ ਹਾਂ ਇਹ ਇਹ ਆਉਣੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਅੱਗੇ ਸਾਰਾ ਸਮਾਜ ਚੱਲਦਾ ਹੈ ਜੇਕਰ ਇਹ ਸਹੀ ਤਰੀਕੇ ਨਾਲ ਸਾਰਾ ਕੁਝ ਚੱਲੀ ਜਾਵੇ ਤਾਂ ਇਸ ਦੇ ਕੋਈ ਜ਼ਿਆਦਾ ਇਲਾਜ ਦੀ ਜ਼ਰੂਰਤ ਨਹੀਂ ਪੈਂਦੀ ਹਾਂ ਕਈ ਜਗ੍ਹਾ 'ਤੇ ਸਮੱਸਿਆਵਾਂ ਆ ਜਾਂਦੀਆਂ ਹਨ ਫਿਰ ਉਹਨਾਂ ਨੂੰ ਕੁਝ ਇਹਨਾਂ ਜਿਹੜੇ ਰੋਗਾਂ ਦੇ ਮਾਹਰ ਨੇ ਔਰਤਾਂ ਦੇ ਡਾਕਟਰ ਨੇ ਉਹਨਾਂ ਦੀਆਂ ਸਲਾਹ ਨਾਲ ਉਹਨਾਂ ਦੇ ਕੋਈ ਦਵਾਈ ਜਾਂ ਕੋਈ ਹੋਰ ਪਾਲਣ ਪੋਸ਼ਣ ਜਾਂ ਕੁਝ ਇੱਦਾਂ ਦੇ ਨਿਯਮ ਹੁੰਦੇ ਹਨ ਉਹ ਸਾਰੇ ਫਿਰ ਉਹਨਾਂ ਨੂੰ ਉਸ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਸਭ ਤੋਂ ਜ਼ਰੂਰੀ ਇੱਕ ਇਹ ਵੀ ਮੈਂ ਇੱਥੇ ਕਹਾਂਗਾ ਇਹ ਤਾਂ ਚਾਹੇ ਕੋਈ ਵੀ ਹੋਵੇ ਸਾਨੂੰ ਸਵੱਛਤਾ ਸਫਾਈ ਤਾਂ ਜ਼ਰੂਰੀ ਰੱਖਣੀ ਚਾਹੀਦੀ ਜਿਸ ਨਾਲ ਸਿਹਤ ਵੀ ਸਾਡੀ ਕਾਮਯਾਬ ਰਹਿੰਦੀ ਹੈ ਇਹ ਇਸ ਲਈ ਸਿਹਤ ਲਈ ਫਾਇਦੇਮੰਦ ਹੈ